ਵੀਹ ਮਈ ਦੋ ਹਜ਼ਾਰ ਚੌਵੀ ਇੱਕ ਜੂਨ ਉੱਨੀ ਸੌ ਨੱਬੇ ਚਾਰ ਦਸਤ ਅਠਾਰਾਂ ਸੌ ਸੱਤਰ ਸਤਾਰਾਂ ਜਨਵਰੀ ਦੋ ਹਜ਼ਾਰ ਦੋ ਛੇ ਨਵੰਬਰ ਉੱਨੀ ਸੌ ਉੱਨੀ